ਹਾਂਜੀ ਮੈਂ ਇੱਕ ਵਾਰੀ ਆਪਣੇ ਦੋਸਤ ਦੇ ਨਾਲ ਪਾਠ 'ਤੇ ਜਾਣਾ ਸੀ ਅਤੇ ਮੈਂ ਐਵੇਂ ਹੀ ਕੈਬ ਬੁੱਕ ਕਰਨ ਬਾਰੇ ਸੋਚਿਆ ਮੈਂ ਕੈਬ ਵਾਲੇ ਨੂੰ ਪੁੱਛਿਆ ਕਿ ਉਹ ਲੰਬੇ ਸਫਰ ਦੀਆਂ ਸਵਾਰੀਆਂ ਹੀ ਚੱਕਦਾ ਜਾਂ ਸਾਰੀਆਂ ਹੀ ਅਤੇ ਮੈਂ ਯੋਜਨਾ ਬਣਾਈ ਮੈਂ ਕੈਬ ਵਿੱਚ ਏਜੰਸੀ ਤੋਂ ਪੁੱਛਿਆ ਤੇਰਾਂ ਤਰੀਕ ਨੂੰ ਉਹਨਾਂ ਦੀ ਕੈਬ ਬੁੱਕ ਹੋ ਸਕਦੀ ਹੈ ਫਿਰ ਸਾਰੀਆਂ ਬੁਕ ਸਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਤੁਸੀਂ ਇੱਕ ਦਿਨ ਪਹਿਲਾਂ ਫ਼ੋਨ ਕਰਕੇ ਪੁੱਛ ਲੈਣਾ ਸੀ